ਉੱਨੀ ਅਗਸਤ ਦੋ ਹਜ਼ਾਰ ਪੰਜ ਦੋ ਦਸੰਬਰ ਦੋ ਹਜ਼ਾਰ ਦੋ ਉੱਨੀ ਜੁਲਾਈ ਦੋ ਹਜ਼ਾਰ ਬਾਰ੍ਹਾਂ ਸੱਤ ਮਾਰਚ ਦੋ ਹਜ਼ਾਰ ਤਿੰਨ ਤੇਈ ਨਵੰਬਰ ਦੋ ਹਜ਼ਾਰ ਇੱਕ